ਜਿਵੇਂ ਕਿ ਸਕੋਲਰਸ਼ਿਪ ਮਿਲਦੀਆਂ ਹਨ ਮੈਰਿਟ ਵਾਲੇ ਬੱਚਿਆਂ ਨੂੰ ਅਤੇ ਜਿਹੜੇ ਹੈਂਡੀਕੈਪਡ ਹੈ ਅਧਰੰਗ ਹੋਇਆ ਜਾਂ ਕੋ ਪੈਰਾਲਾਈਸਿਸ ਵਾਲੇ ਪੇਸ਼ੈਂਟ ਹੈ ਉਹਨਾਂ ਨੂੰ ਫਰੀ ਬੱਸ ਪਾਸਿਸ ਮਿਲਦੇ ਆ ਅਤੇ ਇਹਨਾਂ ਨੂੰ ਅਸਿਸਟਿਵ ਡਿਵਾਈਸ ਜੋ ਕਿ ਜਿਵੇਂ ਕਿ ਵੀਲਚੇਅਰ ਕਰੱਚਿਜ਼ ਇਹ ਸਭ ਜਾਂ ਵੋਕਰ ਇਹ ਸਭ ਵੀ ਦਿੱਤਾ ਜਾਂਦਾ ਮੁਫਤ ਅਤੇ ਇਹਨਾਂ ਦਾ ਰੈਗੂਲਰ ਚੈੱਕਅਪ ਵੀ ਮੁਫਤ ਕਰਵਾਇਆ ਜਾਂਦਾ